ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਤੇਜਪਾਲ ਕੌਰ ਬੋਲ ਰਹੇ ਹੋ ਜੀ ਹਾਂਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਅਸੀਂ ਪਿੰਡ ਸੁਹਾਵੀ ਤੋਂ ਬੋਲ ਰਹੇ ਹਾਂ ਜੀ ਹਾਂਜੀ ਮੈਮ ਇੱਕ ਪ੍ਰੋਬਲਮ ਡਿਸਕਸ ਕਰਨੀ ਸੀ ਜੀ ਮੇਰੀ ਮੰਮਾ ਨੂੰ ਲੈ ਕੇ ਹਾਂਜੀ ਉਹ ਮੈਮ ਉਹਨਾਂ ਦੇ ਨਾ ਮਤਲਬ ਦਰਦ ਹੁੰਦਾ ਸੀ ਜੀ ਪਿੱਤੇ ਦੇ ਵਿੱਚ ਹਾਂਜੀ ਹਾਂਜੀ ਅਸੀਂ ਸਕੈਨ ਕਰਵਾਈ ਸੀ ਅਤੇ ਉਹਨਾਂ ਦੇ ਦਸ ਐੱਮ ਐੱਮ ਦੀ ਪੱਥਰੀ ਆਈ ਹੈ ਜੀ ਪਿੱਤੇ ਦੇ ਵਿੱਚ ਸਕੈਨ ਇੱਥੋਂ ਲੋਕਲ ਮੋਰਿੰਡੇ ਤੋਂ ਕਰਵਾਈ ਸੀ ਜੀ ਨਹੀਂ ਨਹੀਂ ਜੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਮਹੀਨੇ ਤੋਂ ਪੇਨ ਜਿਹੀ ਹੋ ਰਹੀ ਹੈ ਜੀ ਔਰ ਨਹੀਂ ਥੋੜ੍ਹਾ ਬਹੁਤਾ ਪੇਨ ਹੁੰਦਾ ਸੀ ਜੀ ਮੈਡੀਸਨ ਲੈ ਲੈਂਦੇ ਸੀ ਬਟ ਐਨਾ ਪਤਾ ਨਹੀਂ ਸੀ ਜੀ ਸਕੈਨ ਕਰਵਾਏ 'ਤੇ ਪਤਾ ਹੀ ਲੱਗਿਆ ਨਹੀਂ ਨਹੀਂ ਜੀ ਓਪਰੇਸ਼ਨ ਕੋਈ ਵੀ ਨਹੀਂ ਹੋਇਆ ਹੋਇਆ ਹਾਂਜੀ ਅੱਛਾ ਅੱਛਾ ਜੀ ਲੋਕਲ ਹੀ ਡਾਕਟਰ ਤੋਂ ਲਈ ਸੀ ਜੀ ਦਵਾਈ ਠੀਕ ਹੈ ਕੋਈ ਨਹੀਂ ਜੀ ਅਤੇ ਠੀਕ ਹੈ ਜੀ ਔਰ ਜਦੋਂ ਇਹਦਾ ਓਪਰੇਸ਼ਨ ਕਰਵਾਉਣਾ ਮਤਲਬ ਕਿੰਨਾ ਕੁ ਖਰਚਾ ਆ ਜੂਗਾ ਇਹਦਾ ਅੱਛਾ ਜੀ ਅੱਛਾ ਅੱਛਾ ਜੀ ਠੀਕ ਹੈ ਕੋਈ ਨਹੀਂ ਜੀ ਸਲਾਹ ਕਰਕੇ ਇੱਕ ਵਾਰ ਦੱਸ ਦਿੰਦੇ ਹਾਂ ਮੈਂ ਮੰਮਾ ਨੂੰ ਪੁੱਛ ਲੈਂਦੀ ਹਾਂ ਫਿਰ ਦੇਖ ਲੈਂਦੇ ਜੀ ਠੀਕ ਹੈ ਓਕੇ ਥੈਂਕ ਯੂ ਮੈਮ ਠੀਕ ਹੈ ਓਕੇ